ਸਾਡੇ ਪਿੰਡ ਦੇ ਨੌਜਵਾਨ ਵੱਖ ਵੱਖ ਡਾਂਸ ਫਾਰਮਾਂ ਨਾਲ ਕਈ ਤਰੀਕਿਆਂ ਨਾਲ ਡਾਂਸ ਮਨੁੱਖ ਦੇ ਖੁਸ਼ੀ ਦਾ ਸਰੋਤ ਹੈ ਕਿਉਂਕੀ ਜਦੋਂ ਮਨੁੱਖ ਖੁਸ਼ ਹੁੰਦਾ ਹੈ ਜਾਂ ਕਿਸੇ ਦੇ ਵਿਆਹ ਆਦਿ ਮੌਕਿਆਂ ਉੱਤੇ ਡਾਂਸ ਕੀਤਾ ਜਾਂਦਾ ਹੈ ਆਮ ਤੌਰ 'ਤੇ ਪਿੰਡਾਂ ਵਿੱਚ ਜਦੋਂ ਵਿਸਾਖੀ ਦਾ ਮੇਲਾ ਜਾ ਲੋਹੜੀ ਦੇ ਤਿਉਹਾਰ 'ਤੇ ਪਿੰਡ ਦੇ ਨੌਜਵਾਨ ਭੰਗੜਾ ਪਾਉਂਦੇ ਹਨ ਇਸ ਪ੍ਰਕਾਰ ਨਰਾਤਿਆਂ ਵਿੱਚ ਗਰਬਾ ਵੀ ਪਾਇਆ ਜਾਂਦਾ ਹੈ ਇਸ ਤਰ੍ਹਾਂ ਨੌਜਵਾਨ ਵੱਖ ਵੱਖ ਡਾਂਸ ਫਾਰਮਾਂ ਨਾਲ ਜੁੜਦੇ ਹਨ